ਹੈਲੋ ਬਿਜਲੀ ਬੋਰਡ ਦਫਤਰ ਤੋਂ ਬੋਲ ਰਹੇ ਹੋ ਹਾਂਜੀ ਸਰ ਮੈਨੂੰ ਕੱਲ ਬਿਜਲੀ ਬੋਰਡ ਵੱਲੋ ਬਿਜਲੀ ਦਾ ਬਿੱਲ ਮਿਲਿਆ ਹੈ ਜਿਸ ਵਿੱਚ ਤੁਸੀਂ ਬਹੁਤ ਵਾਧੂ ਕਿਸਮ ਦੇ ਖਰਚ ਪਾ ਦਿੱਤੇ ਹਨ ਪਹਿਲੀ ਗੱਲ ਮੇਰੀਆਂ ਸਿਰਫ ਦੋ ਸੌ ਯੂਨਿਟਾਂ ਹੀ ਖਰਚ ਹੋਈਆਂ ਹਨ ਜਦ ਕਿ ਤੁਸੀਂ ਮੈਨੂੰ ਛੇ ਸੌ ਯੂਨਿਟ ਦਾ ਬਿੱਲ ਭੇਜ ਦਿੱਤਾ ਉਸ ਉੱਤੇ ਦੀ ਵੱਖ ਵੱਖ ਤਰ੍ਹਾਂ ਦੇ ਚਾਰਜ ਖਰਚੇ ਲਗਾ ਦਿੱਤੇ ਜਿਵੇਂ ਕਿ ਜੀ ਐਸ ਟੀ ਦਾ ਐਕਸਟਰਾ ਚਾਰਜ ਸਬਸਿਡੀ ਦਾ ਐਕਸਟਰਾ ਚਾਰਜ ਯੂਨਿਟਾਂ ਦੇ ਐਕਸਟਰਾ ਚਾਰਜ ਜੀ ਐਸ ਟੀ ਦੇ ਐਕਸਟਰਾ ਚਾਰਜ ਕਿਉਂਕਿ ਮੇਰੇ ਵੱਲੋਂ ਖਰਚ ਕੀਤੀਆਂ ਦੋ ਸੌ ਯੂਨਿਟਾਂ ਦੀ ਬਦਲੇ ਤੁਸੀਂ ਸਾਰੇ ਖਰਚੇ ਛੇ ਸੌ ਯੂਨਿਟਾਂ ਉੱਤੇ ਲਗਾ ਦਿੱਤੇ ਜਦ ਕਿ ਪਹਿਲੀ ਗੱਲ ਮੇਰੇ ਘਰ ਵਿਚ ਲਾਈਟ ਦੀ ਖਪਤ ਬਹੁਤ ਘੱਟ ਹੁੰਦੀ ਹੈ ਨਾ ਤਾਂ ਮੇਰੇ ਘਰੇ ਏ ਸੀ ਹੈ ਤੇ ਨਾਂ ਹੀ ਕਿਸੇ ਤਰ੍ਮੋਹਾ ਦੀ ਕੋਈ ਮੋਟਰ ਹੈ ਜੋ ਬਿਜਲੀ ਦੀਆਂ ਯੂਨਿਟਾਂ ਨਾਲ ਖਰਚ ਵਧਾ ਸਕੇ ਇਹਨਾ ਖਰਚਾ ਨੂੰ ਠੀਕ ਕਰਕੇ ਮੈਨੂੰ ਬਿਜਲੀ ਦਾ ਬਿੱਲ ਦੁਬਾਰਾ ਭੇਜਿਆ ਜਾਵੇ ਮੇਰੀ ਇਸ ਬੇਨਤੀ ਨੂੰ ਸਤਿਕਾਰ ਕੀਤਾ ਜਾਵੇ ਜੀ